ਭੰਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸ ਰਿਹਾ ਹਾਂ ਭੰਗੜੇ ਵਿੱਚ ਬਹੁਤ ਵਧੀਆ ਇੱਕ ਰੰਗ ਦੀਆਂ ਪੱਗਾਂ ਤੁੱਲੇਦਾਰ ਪੱਗਾਂ ਅਤੇ ਬਰ ਜਿਹੜਾ ਵਰਦੀ ਵਗੈਰਾ ਪਾਉਣੀ ਹੈ ਕੁੜ ਸ਼ਰਟ ਵਗੈਰਾ ਪਾਉਣੀ ਹੈ ਕੁੜਤਾ ਪਾਉਣਾ ਹੈ ਉਹ ਵੀ ਇੱਕ ਰੰਗ ਦੇ ਹੁੰਦੇ ਨੇ ਚਾਦਰੇ ਵੀ ਇੱਕ ਰੰਗ ਦੇ ਹੁੰਦੇ ਹਨ ਜੁੱਤੀ ਦੋਕ ਵਾਲੀ ਅਤੇ ਗੱਲ ਵਿੱਚ ਕੈਂਠੇ ਵਧੀਆ ਇੱਕ ਰੰਗ ਦੀਆਂ ਜਾਗਟਾਂ ਜੋ ਬਹੁਤ ਵਧੀਆ ਬਣੀਆਂ ਹੁੰਦੀਆਂ ਹਨ ਭੰਗੜਾ ਪਾਰਟੀ ਦੀ ਬਹੁਤ ਵਧੀਆ ਸਜਾਵਟ ਬਣ ਜਾਂਦੀ ਹੈ ਅਤੇ ਭੰਗੜੇ ਵਿੱਚ ਜੋ ਵੀ ਬ ਬੱਚੇ ਭੰਗੜਾ ਪਾਉਂਦੇ ਹਨ ਉਹਨਾਂ ਦੀ ਪ੍ਰਦਰਸ਼ਨੀ ਦੇ ਬਹੁਤ ਚਾਰ ਚੰਦ ਲੱਗ ਜਾਂਦੇ ਹਨ ਇਸ ਲਈ ਸਾਰਿਆਂ ਭੰਗੜਿਆਂ ਵਾਲਿਆਂ ਲਈ ਵਰਦੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਇੱਕੋ ਜਿਹਾ ਡਾਂਸ ਹੋਣਾ ਚਾਹੀਦਾ ਹੈ ਸਾਰੇ ਬੱਚੇ ਰਲ ਮਿਲ ਕੇ ਭੰਗੜਾ ਪਾਉਂਦੇ ਹਨ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਇਸ ਲਈ ਤੁੱਲੇ ਵਾਲੀ ਪੱਗ ਅਤੇ ਚਿਮਟਾ ਖੜਕਾਉਂਦਾ ਕੋਈ ਵਾਜਾ ਖੜਕਾਉਂਦਾ ਕੋਈ ਢੋਲਕੀ ਖੜਕਾਉਂਦਾ ਹੈ ਇਹ ਸਾਰੇ ਅੱਡੋ ਅੱਡੀ ਆਪੋ ਆਪਣੇ ਰਾਗ ਦੇ ਨਾਲ ਭੰਗੜੇ ਦੇ ਨਾਲ ਮੇਲ ਕੇ ਚੱਲਦੇ ਹਨ ਕੋਈ ਭੰਗੜਾ ਪਾਉਂਦਾ ਗਿੱਧਾ ਪਾਉਂਦਾ ਹੈ ਕੋਈ ਇਸ ਤਰ੍ਹਾਂ ਭੰਗੜੇ ਦੇ ਵਿੱਚ ਜੋ ਵੀ ਵਰਦੀ ਪਾਈ ਜਾਂਦੀ ਹੈ ਕੱਪੜੇ ਪਾਈ ਜਾਂਦੇ ਹਨ ਹੋਰ ਭੰ ਭੰਗੜਾ ਪਾਉਣ ਵਾਲੀਆਂ ਗੱਲਾਂ ਕਰਦੇ ਹਨ ਜਿਵੇਂ ਆਪਣੇ ਚਿਮਟਾ ਖੜਕਾਉਂਦਾ ਕੋਈ ਪੋਲਕੀ ਵਜਾਉਂਦਾ ਕੋਈ ਕੋਈ ਭੰਗੜੇ ਵਾਲੀ ਉਹ ਆਈਟਮ ਲੈਂਦਾ ਹੈ ਇਸ ਕਰਕੇ ਸਾਰੇ ਰਲ ਮਿਲ ਕੇ ਇਸ ਨੂੰ ਇੱਕ ਨਾਮ ਵਿੱਚ ਲੈ ਜਾਂਦੇ ਹਨ ਜੋ ਕਿ ਮੌਕੇ ਦੀ ਸਜਾਵਟ ਬਣ ਜਾਂਦੀ ਹੈ ਇਸ ਲਈ ਭੰਗੜੇ ਦੇ ਵਿੱਚ ਬਹੁਤ ਹੀ ਵਧੀਆ ਦੇਖਣ ਨੂੰ ਓਰ ਬਰ ਬਹੁਤ ਵਧੀਆ ਮਨ ਲੱਗਦਾ ਹੈ ਇਸ ਲਈ ਭੰਗੜਾ ਬਹੁਤ ਹੀ ਪੰਜਾਬ ਦੀ ਬਹੁਤ ਵਧੀਆ ਪੁਰਾਣੀ ਆਈਟਮ ਹੈ ਇਸ ਕਰਕੇ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ